ਤਕਨੋਲੋਜੀ ਸਾਡੇ ਦੁਆਰਾ ਖਰੀਦਦਾਰੀ ਕਰਨ ਅਤੇ ਖਰੀਦਦਾਰੀ ਕਰਨ ਦੇ ਤਰੀਕੇ ਨੂੰ ਬਹੁਤ ਬਦਲ ਰਹੀ ਹੈ ਪਹਿਲਾਂ ਜਦੋਂ ਅਸੀਂ ਖਰੀਦਦਾਰੀ ਕਰਨੀ ਹੁੰਦੀ ਸੀ ਤਾਂ ਅਸੀਂ ਬਾਹਰ ਨਿਕਲਦੇ ਸੀ ਦੁਕਾਨਾਂ 'ਤੇ ਜਾਂਦੇ ਸੀ ਚਾਰ ਦੁਕਾਨਾਂ ਘੁੰਮਦੇ ਸੀ ਫਿਰ ਉਹਦੇ ਵਿੱਚੋਂ ਜਿਹੜੇ ਕਿ ਸਾਰੀਆਂ ਦੁਕਾਨਾਂ 'ਤੇ ਆਲਮੋਸਟ ਸੇਮ ਹੀ ਵਰਾਇਟੀ ਹੁੰਦੀ ਸੀ ਅਸੀਂ ਜਾਂਦੇ ਸੀ ਉੱਥੇ ਘੁੰਮਦੇ ਸੀ ਫਿਰ ਉਹਦੇ ਵਿੱਚੋਂ ਇੱਕ ਚੀਜ਼ ਪਸੰਦ ਕਰਕੇ ਲੈ ਕੇ ਆਉਂਦੇ ਸੀ ਪਰ ਅੱਜ ਕੱਲ੍ਹ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਤੁਸੀਂ ਆਨਲਾਈਨ ਦੇਖੋ ਪਸੰਦ ਕਰੋ ਅਤੇ ਤੁਸੀਂ ਤੁਹਾਡੇ ਘਰ ਪਹੁੰਚ ਜਾਏਗੀ ਈ ਈਵਨ ਕਿ ਤੁਸੀਂ ਫੋਨ ਲੈਣਾ ਕੋਈ ਵੀ ਵੱਡੀ ਤੋਂ ਵੱਡੀ ਚੀਜ਼ ਕੋਈ ਟੀਵੀ ਕੁਛ ਵੀ ਟੀਵੀ ਫ੍ਰਿਜ ਈਵਨ ਅੱਜ ਕੱਲ੍ਹ ਤਾਂ ਬਹੁਤ ਵੱਡੀਆਂ ਵੱਡੀਆਂ ਮਸ਼ੀਨਾਂ ਵੀ ਲੋਕ ਆਨਲਾਈਨ ਮੰਗਵਾਉਂਦੇ ਹੈ ਤਾਂ ਆਨਲਾਈਨ ਖਰੀਦਦਾਰੀ ਕਰਨ ਦਾ ਤਰੀਕਾ ਬਹੁਤ ਬਦਲ ਚੁੱਕਿਆ ਹੈ ਜਿਵੇਂ ਕਿ ਕੋਈ ਵੀ ਚੀਜ਼ ਤੁਸੀਂ ਖਰੀਦਣੀ ਹੈ ਤਾਂ ਤੁਸੀਂ ਜਾਓ ਉੱਥੇ ਉਸ ਚੀਜ਼ 'ਤੇ ਕਲਿੱਕ ਕਰੋ ਉਹ ਤੁਹਾਨੂੰ ਉੱਥੇ ਟੈਕਨੋਲੋਜੀ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੋਈ ਹੈ ਕਿ ਉਹ ਚੀਜ਼ ਤੁਹਾਨੂੰ ਮੈਨੀਕਉਨ ਦੇ ਪਾ ਕੇ ਜਿਹੜਾ ਉੱਥੇ ਪੁਤਲਾ ਹੁੰਦਾ ਉਹਦੇ ਉੱਪਰ ਪਾ ਕੇ ਤੁਹਾਨੂੰ ਦਿਖਾਣਗੇ ਕਿ ਇਹ ਕਿਵੇਂ ਦਾ ਲੱਗੇਗਾ ਤੁਹਾਡੇ ਉੱਪਰ ਤੁਹਾਡੇ ਸਾਈਜ਼ ਦਾ ਤੁਸੀਂ ਦੱਸ ਸਕਦੇ ਹੋ ਕਿ ਆਹ ਮੇਰਾ ਸਾਈਜ਼ ਹੈ ਅਤੇ ਇਸ ਸਾਈਜ਼ ਦੇ ਬੰਦੇ ਦੇ ਉੱਤੇ ਇਹ ਚੀਜ਼ ਕਿੰਨੀ ਜਚੇਗੀ ਈਵਨ ਐਨਕਾਂ ਐਨਕਾਂ ਤਾਂ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਐਨਕਾਂ ਵੀ ਅਸੀਂ ਆਨਲਾਈਨ ਜਾ ਕੇ ਖਰੀਦਾਂਗੇ ਟੈਕਨੋਲੋਜੀ ਦੇ ਜਰੀਏ ਪਰ ਹੁਣ ਆਪਾਂ ਉਹ ਵੀ ਖਰੀਦ ਰਹੇ ਹਾਂ ਅਤੇ ਸਿਰਫ ਉਹ ਕੀ ਕਰਦਾ ਹੈ ਕਿ ਤੁਹਾਡੇ ਮੂੰਹ 'ਤੇ ਤੁਹਾਡਾ ਬਣਾ ਦਿੰਦਾ ਹੈ ਐਨਕ ਅਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੇਰੇ ਮੂੰਹ 'ਤੇ ਕੀ ਜੱਚ ਰਿਹਾ ਕੀ ਨਹੀਂ ਜੱਚ ਰਿਹਾ ਅਤੇ ਉਸ ਦੇ ਹਿਸਾਬ ਨਾਲ ਤੁਸੀਂ ਉਹਨੂੰ ਵਰਤ ਸਕਦੇ ਹੋ ਤਾਂ ਟੈਕਨੋਲੋਜੀ ਜਿਹੜੀ ਹੈ ਖਰੀਦਦਾਰੀ ਕਰਨ ਅਤੇ ਖਰੀਦਦਾਰੀ ਦੇ ਸਾਰੇ ਕਰਨ ਦੇ ਸਾਰੇ ਤਰੀਕਿਆਂ ਨੂੰ ਹੁਣ ਬਹੁਤ ਜ਼ਿਆਦਾ ਹੱਦ ਤੱਕ ਬਦਲ ਚੁੱਕੀ ਹੈ